ਮੈਂ ਆਪਣੇ ਇਲਾਕੇ ਦੀ ਸਫਾਈ ਕਰਨ ਲਈ ਆਪਣੇ ਆਲੇ ਦੁਆਲੇ ਪੂਰੇ ਸਾਫ ਸਫਾਈ ਰੱਖਦਾ ਜਿਹਦੇ ਵਿੱਚ ਜੇ ਕੋਈ ਕੂੜਾ ਕਰਕਟ ਇੱਧਰ ਉੱਧਰ ਪਿਆ ਹੋਵੇ ਤਾਂ ਮੈਂ ਧਿਆਨ ਰੱਖਦਾ ਹਾਂ ਕਿ ਅੱਗੇ ਤੋਂ ਦੁਬਾਰਾ ਇੱਥੇ ਕੂੜਾ ਨਾ ਪਵੇ ਅਤੇ ਲੋਕਾਂ ਨੂੰ ਵੀ ਜਾਣਕਾਰੀ ਦਿੰਦਾ ਹਾਂ ਕਿ ਉਹ ਆਪਣਾ ਕਚਰਾ ਸਹੀ ਸਹੀ ਸਥਾਨ 'ਤੇ ਨਿਪਟਾਰਾ ਲਾਨ ਅਤੇ ਅਲੱਗ ਅਲੱਗ ਲਿਫਾਫਿਆਂ ਦੇ ਵਿੱਚ ਜਿੱਦਾਂ ਡਿਸਟਰੀਬਿਊਟ ਕਰਨ ਜੋ ਕਿ ਸਰਕਾਰ ਦੀਆਂ ਨਿਊਜ਼ ਸਰਕਾਰ ਦੇ ਗਾਈਡਲਾਈਨਸ ਹੈਗੀਆਂ ਆ ਇਹ ਤੋਂ ਇਲਾਵਾ ਉਹਨਾਂ ਨੂੰ ਮੈਂ ਆਲੇ ਦੁਆਲੇ ਆਪਣੇ ਕੂੜਾ ਕਚਰਾ ਸੁੱਟਣ ਤੋਂ ਵੀ ਮਨਾ ਕਰਦਾ ਬੱਚਿਆਂ ਨੂੰ ਵੀ ਦੱਸਦੇ ਹਾਂ ਕਿ ਆਪਣਾ ਜੋ ਕੂੜਾ ਕਚਰਾ ਉਹ ਆਪਣੇ ਘਰ ਦੇ ਲਾਗੇ ਛਾਗੇ ਨਾ ਸੁੱਟਣ ਉਹ ਆਪਣੇ ਡਸਬਿਨ ਦਾ ਯੂਜ ਕਰਨ ਅਤੇ ਇਹ ਤੋਂ ਇਲਾਵਾ ਜਿਹੜਾ ਆਪਣੇ ਪਾਣੀ ਜਿੱਥੇ ਵੀ ਖੜਾ ਹੁੰਦਾ ਆ ਮੈਂ ਆਪਣੇ ਆਂਢ ਗੁਆਂਢ ਨੂੰ ਦੱਸਦਾ ਉਹਨਾਂ ਨੂੰ ਕਿ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਹਨ ਅਤੇ ਮੱਛਰ ਵਗੈਰਾ ਪੈਦਾ ਹੁੰਦੇ ਹਨ ਜੋ ਕਿ ਪਾਣੀ ਇਕੱਠਾ ਨਾ ਹੋਣ ਦੇਣ ਜੋ ਕਿ ਉਹਨਾਂ ਦੇ ਕੱਲ ਨੂੰ ਖਰਚੇ ਦਾ ਵੀ ਕਾਰਨ ਬਣਦਾ ਹੈ ਵੱਡਾ ਆਪਣਾ ਅਤੇ ਇਹ ਤੋਂ ਇਲਾਵਾ ਜਿਹੜੇ ਲਿਫਾਫੇ ਵਗੈਰਾ ਖਾਣ ਪੀਣ ਵਾਲੀਆਂ ਚੀਜ਼ਾਂ ਸੁੱਟ ਦਿੰਦੇ ਆ ਉਹ ਕੁੱਤੇ ਜਾਂ ਜਾਨਵਰ ਖਾ ਕੇ ਮਰ ਜਾਂਦੇ ਨੇ ਅਤੇ ਉਹ ਵੀ ਮੈਂ ਉਹਨਾਂ ਨੂੰ ਕਹਿੰਦਾ ਕਿ ਜੇ ਕੁਝ ਸੁੱਟਣਾ ਆ ਤਾਂ ਆਪਣੇ ਜਾਂ ਤਾਂ ਖੁੱਲਾ ਸੁੱਟੋ ਲਿਫਾਫੇ ਦੇ ਵਿੱਚ ਨਾ ਪਾ ਕੇ ਸੁੱਟੋ ਤਾਂ ਕਿ ਉਹ ਗਲ ਗਲ ਕਲ ਗਲ ਸੜ ਕੇ ਖਤਮ ਹੋ ਜਾਏਗਾ ਆਪੇ ਹੀ ਪਲਾਸਟਿਕ ਦੀ ਜਗ੍ਹਾ 'ਤੇ ਆਪਣਾ ਲਿਫਾਫਾ ਜਾਂ ਪੇਪਰ ਯੂਜ ਕਰ ਲੈਣ ਅਤੇ ਜਿਹਨਾਂ ਤੋਂ ਜਿੰਨੇ ਜ਼ਿਆਦਾ ਹੋ ਸਕੇ ਜਾਂ ਤਾਂ ਕਚਰਾ ਆਪਣਾ ਕਿਸੀ ਡਿਸਟਰੀਬਿਊਟਰ ਜਿੱਥੇ ਜਗ੍ਹਾ ਹੈਗੀ ਆ ਉੱਥੇ ਹੀ ਸੁੱਟਣ ਇੱਧਰ ਉੱਧਰ ਆਲਾ ਦੁਆਲਾ ਆਪਣਾ ਸਾਫ ਰੱਖਣ ਅਤੇ ਝਾੜੂ ਰੋਜ਼ ਸਵੇਰੇ ਆਪਣਾ ਸਾਫ ਸਫਾਈ ਕਰਨ ਉਹਦੇ ਨਾਲ ਨਾਲ ਆਪਣੇ ਆਂਡ ਗੁਆਂਡ ਦੇ ਵੀ ਸਫਾਈ